ਫੋਟੋਆਂ ਦੀ ਹਾਰਡ ਕੋਪੀ ਹਰ ਬੰਦੇ ਕੋਲ ਐਲਬਮ ਦੇ ਰੂਪ ਵਿੱਚ ਪਈ ਹੁੰਦੀ ਆ ਇਸ ਵਿੱਚ ਉਹਦੇ ਜੀਵਨ ਦੇ ਵਿਸ਼ੇਸ਼ ਅਵਸਰ ਜਿੱਦਾਂ ਵਿਆਹ ਸ਼ਾਦੀ ਬੱਚਿਆਂ ਦੇ ਜਨਮਦਿਨ ਵਿੱਚ ਖਿੱਚੀਆਂ ਗਈਆਂ ਫੋਟੋਆਂ ਸਾਂਭੀਆਂ ਹੁੰਦੀਆਂ ਨੇ ਇਹ ਉਹ ਆਪਣੀ ਅਗਲੀ ਪੀੜ੍ਹੀ ਨੂੰ ਦਿਖਾਉਂਦਾ ਹੈ ਜਿਹੜੇ ਜਿਹੜੇ ਇਹਦੇ ਪੁਰਾਣੇ ਅਵਸਰ ਹੁੰਦੇ ਨੇ ਅਤੇ ਉਹਨਾਂ ਦਿਨਾਂ ਨੂੰ ਯਾਦ ਕਰਦਾ ਹੈ ਹੁਣ ਟੈਕਨੋਲੋਜੀ ਦੇ ਬਦਲਣ ਕਰਕੇ ਡਿਜ਼ੀਟਲ ਫੋਟੋਗ੍ਰਾਫੀ ਸ਼ੁਰੂ ਹੋ ਗਈ ਹੈ ਇਹਦੇ ਨਾਲ ਕਈ ਐਪ ਆ ਗਏ ਹੈਗੇ ਜਿਹਦੇ ਰਾਹੀਂ ਤੁਸੀਂ ਆਪਣੀ ਫੋਟੋਆਂ ਨੂੰ ਥੋੜ੍ਹਾ ਬਹੁਤ ਹੋਰ ਚੰਗਾ ਕਰ ਸਕਦੇ ਹੋ ਅਤੇ ਐਡਿਟ ਕਰ ਸਕਦੇ ਹੋ ਜੀਹਦੇ ਨਾਲ ਫੋਟੋਆਂ ਦਾ ਮੂਲ ਜਿਹੜੇ ਸਾਡੇ ਭਾਵ ਹੁੰਦੇ ਉਹ ਵੀ ਬਦਲ ਜਾਂਦੇ ਨੇ ਇਸ ਕਰਕੇ ਹਾਰਡ ਕੋਪੀ ਜ਼ਿਆਦਾ ਚੰਗੀਆਂ ਹੁੰਦੀਆਂ ਨੇ